ਹਾਂ ਸਮੇਂ ਦੇ ਨਾਲ ਨਾਲ ਜੋ ਆਪਣਾ ਪੰਜਾਬ ਦਾ ਰਿਸ਼ਤਾ ਹੈ ਉਹ ਦੁਨੀਆ ਨਾਲ ਕੁਝ ਇਸ ਤਰ੍ਹਾਂ ਬਦਲਿਆ ਜੀ ਦੇਖੋ ਪਹਿਲਾ ਜੋ ਆਪਾਂ ਅਕਸਰ ਹੀ ਦੇਖਦੇ ਹਾਂ ਕਿ ਪ੍ਰਾਚੀਨ ਸਮੇਂ ਤੋਂ ਹੀ ਪੰਜਾਬ ਆਪਣਾ ਦਰਿਆ ਉਹ ਰਿਹਾ ਰਸਤਾ ਰਿਹਾ ਜੋ ਵੀ ਕੋਈ ਹਮਲਾਵਰ ਆਉਂਦਾ ਸੀ ਉਹ ਪੰਜਾਬ ਵਿੱਚੋਂ ਐਂਟਰ ਹੁੰਦਾ ਸੀ ਇਸ ਕਰਕੇ ਪੰਜਾਬ ਨੇ ਬਹੁਤ ਹੀ ਜ਼ਿਆਦਾ ਮਾਰਾ ਝੱਲੀਆਂ ਨੇ ਬਹੁਤ ਹੀ ਜ਼ਿਆਦਾ ਇੱਥੇ ਸਾਡੇ ਸੂਰਵੀਰ ਯੋਧੇ ਹੋਏ ਨੇ ਜੋ ਕਿ ਇਹਨਾਂ ਮਾਰਾਂ ਦਾ ਸਹਿਣ ਕਰਕੇ ਹੁੰਦੇ ਹੋਏ ਵੀ ਪੰਜਾਬ ਡੋਲਿਆ ਨਹੀਂ ਬਾਕੀ ਰਹੀ ਸੱਭਿਆਚਾਰ ਦੀ ਗੱਲ ਪਹਿਰਾਵੇ ਦੀ ਗੱਲ ਖਾਣ ਪੀਣ ਦੀ ਗੱਲ ਤਾਂ ਜੋ ਇਹ ਅਸੀਂ ਦੂਸਰੇ ਦੇਸ਼ਾਂ ਤੋਂ ਜੋ ਕੁ ਗ੍ਰਹਿਣ ਕੀਤਾ ਹੈ ਉਹਦੇ ਵਿੱਚ ਪੱਛਮੀ ਸੱਭਿਆਚਾਰ ਜ਼ਿਆਦਾ ਅ ਪੰਜਾਬ ਉੱਪਰ ਹਾਵੀ ਹੋਇਆ ਹੈ ਜੋ ਕਿ ਅਸੀਂ ਦੇਖਦੇ ਹੀ ਹਾਂ ਕਿ ਅੱਜ ਕ ਅੱਜ ਦੇ ਜਮਾਨੇ ਦੀ ਗੱਲ ਕਰੀਏ ਤਾਂ ਆਪਣੇ ਪੰਜਾਬੀ ਮੁੰਡੇ ਕੁੜੀਆਂ ਲਾ ਲਓ ਬਾਹਰ ਜਾਣ ਲਈ ਜ਼ਿਆਦਾ ਉਤਸੁਕ ਹਨ ਅ ਉਹਨਾਂ ਨੂੰ ਬਾਹਰ ਜਾ ਕੇ ਪੈਸਾ ਕਮਾਉਣ ਦੀ ਜਿਹੜੀ ਭੱਜ ਦੌੜ ਲੱਗੀ ਹੋਈ ਹੈ ਸੋ ਇਸ ਕਰਕੇ ਸਮੇਂ ਦੇ ਨਾਲ ਨਾਲ ਦੁਨੀਆ ਨਾਲ ਪੰਜਾਬ ਦਾ ਰਿਸ਼ਤਾ ਵੱਖਰੇ ਵੱਖਰੇ ਤਰੀਕੇ ਨਾਲ ਵੱਖਰੇ ਵੱਖਰੇ ਢੰਗਾਂ ਨਾਲ ਅ ਸਥਾਪਿਤ ਹੁੰਦਾ ਰਿਹਾ ਹੈ ਅਤੇ ਇਸ ਤਰ੍ਹਾਂ ਹੀ ਹਰ ਪੀੜ੍ਹੀ ਆਪਣੇ ਅੰਦਰ ਹੋਰਨਾਂ ਦੇਸ਼ਾਂ ਵਾਂਗ ਜਾਂ ਹੋਰ ਦੁਨੀਆ ਵਾਂਗ ਦੇਖ ਦੇਖ ਕੇ ਆਪਣਾ ਜਿਹੜਾ ਸੱਭਿਆਚਾਰ ਹੈ ਉਹ ਬਦਲ ਰਹੇ ਹਨ ਸੋ ਸਾਨੂੰ ਲੋੜ ਹੈ ਕਿ ਅਸੀਂ ਵੀ ਆਪਣੇ ਸੱਭਿਆਚਾਰ ਨੂੰ ਬਚਾਉਣ ਦੀ ਕੋਸ਼ਿਸ਼ ਕਰੀਏ ਤੇ ਆਪਣੇ ਇੱਕ ਨਿੱਕੀ ਜਿਹੀ ਕੋਸ਼ਿਸ਼ ਕਰਕੇ ਅ ਆਪਣੇ ਸੱਭਿਆਚਾਰ ਨੂੰ ਬਚਾਈਏ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਆਪਣੇ ਪੰਜਾਬੀ ਸੱਭਿਆਚਾਰ ਵਿਰਸੇ ਬਾਰੇ ਪਤਾ ਲੱਗ ਸਕੇ